ਪੰਜਾਬ ਦੇ ਵਿੱਚ ਖੇਡ ਖੇਤਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਲਿੰਗ ਸਮਾਨਤਾ ਹੈਗੀ ਹੈ ਮੁੰਡੇ ਅਤੇ ਕੁੜੀਆਂ ਨੂੰ ਬਰਾਬਰ ਖੇਡਣ ਦਾ ਹੱਕ ਹੈ ਜਿਸ ਦੇ ਵਿੱਚ ਭਾਵੇਂ ਉਹ ਮੇਲ ਆਪਣਾ ਮਰਦ ਹੈ ਭਾਵੇਂ ਉਹ ਔਰਤ ਹੈ ਉਹਨਾਂ ਨੂੰ ਹਰੇਕ ਖੇਡ ਦੇ ਵਿੱਚ ਖੇਡਣ ਦੀ ਸਮਾਨਤਾ ਹੈਗੀ ਹੈ ਜੇਕਰ ਉਹਨਾਂ ਨੂੰ ਖੇਡ ਦੀ ਸਮਾਨਤਾ ਹੈਗੀ ਹੈ ਤਾਂ ਅੱਗੇ ਜਾ ਕੇ ਉਹ ਨੈਸ਼ਨਲ ਗੇਮਾਂ ਦੇ ਵਿੱਚ ਵੀ ਖੇਡ ਸਕਦੇ ਹਨ ਸਾਡਾ ਖੇਡ ਦਾ ਮਤਲਬ ਇਹ ਹੁੰਦਾ ਹੈ ਬਈ ਖੇਡ ਦੀ ਭਾਵਨਾ ਨੂੰ ਸਪਿਰਟ ਨੂੰ ਉਹਨਾਂ ਦੇ ਵਿੱਚ ਕਾਬਲੀਅਤ ਨੂੰ ਨੂੰ ਦੇਖਣਾ ਜੇਕਰ ਅਸੀਂ ਕਾਬਲੀਅਤਾਂ ਨੁ ਕਾਬਲੀਅਤ ਜਿਹੜੀ ਹੈਗੀ ਹੈ ਉਹ ਅਸੀਂ ਕੋਈ ਮਰਦ ਜਾਂ ਔਰਤ ਦੇ ਆਧਾਰ 'ਤੇ ਨਹੀਂ ਦੇਖਦੇ ਅਸੀਂ ਵੇਖਦੇ ਇਹਦੇ 'ਚ ਖੇਡਣ ਦੀ ਭਾਵਨਾ ਕਿੰਨੀ ਕੁ ਹੈ ਕਿਹੜਾ ਕਿੰਨੀ ਵਧੀਆ ਤਰੀਕੇ ਨਾਲ਼ ਖੇਡ ਸਕਦਾ ਹੈ ਅਤੇ ਜੇਕਰ ਇਹਨਾਂ ਦੇ ਵਿੱਚ ਖੇਡਣ ਦੀ ਭਾਵਨਾ ਹੈਗੀ ਹੈ ਤਾਂ ਵਤਨ ਦੀਆਂ ਖੇਡਾਂ ਜਾਂ ਮੇ ਪੰਜਾਬ ਦੇ ਵਿੱਚ ਹੋਰ ਤਰੀਕ ਤਰੀਕੇ ਦੀਆਂ ਖੇਡਾਂ ਜਿਹੜੀਆਂ ਹੈਗੀਆਂ ਉਹ ਚੱਲਦੀਆਂ ਹਨ ਉਹਨਾਂ ਦੇ ਵਿੱਚ ਮਰਦ ਅਤੇ ਔਰਤਾਂ ਦੇ ਵਿੱਚ ਕੋਈ ਭਿੰਨਤਾ ਨਹੀਂ ਹੁੰਦੀ ਅਤੇ ਹਰੇਕ ਜਿਹੜਾ ਹੈਗਾ ਹੈ ਆਪਣੇ ਏਜ਼ ਦੇ ਅਕੋਡਿੰਗਲੀ ਕਿਉਂਕਿ ਉਹਨਾਂ ਵਿੱਚ ਏਜ਼ ਬਣੀ ਹੁੰਦੀ ਹੈ ਵੀ ਐਨੇ ਸਤਾਰ੍ਹਾਂ ਸਾਲ ਤੱਕ ਵੀਹ ਸਾਲ ਤੱਕ ਪੱਚੀ ਸਾਲ ਤੱਕ ਤੀਹ ਸਾਲ ਤੱਕ ਵੀ ਇਹਨਾਂ ਦੇ ਵਿੱਚ ਭਾਗ ਲੈ ਸਕਦਾ ਹੈ ਤਾਂ ਉਹ ਭਾਗ ਲੈ ਕੇ ਆਪਣੀ ਜਿਹੜੀ ਹੈਗੀ ਹੈ ਕਾਬਲੀਅਤ ਨੂੰ ਦਿਖਾਵੇ ਅਤੇ ਖੇਡ ਖੇਤਰ ਦੇ ਵਿੱਚ ਆਪਣਾ ਨਾਮ ਰੋਸ਼ਨ ਕਰ ਸਕਦਾ ਧੰਨਵਾਦ